ਅਸੀਂ ਪਿਛਲੇ ਕੁਛ ਸਮੇਂ ਤੋਂ ਰਾਜਸਥਾਨ ਪ੍ਰਦੇਸ਼ ਵਿੱਚ ਵਪਾਰ ਕਰਦੇ ਹਾਂ ਅਸੀਂ ਜਦੋਂ ਵੀ ਉੱਥੇ ਜਾਂਦੇ ਹਾਂ ਤਾਂ ਉੱਥੇ ਸੁਰੱਖਿਆ ਸੰਬੰਧੀ ਸਾਨੂੰ ਕੋਈ ਵੀ ਚਿੰਤਾ ਦਾ ਅਨੁਭਵ ਨਹੀਂ ਕਰਨਾ ਪੈਂਦਾ ਉੱਥੋਂ ਦੀ ਕਾਨੂੰਨੀ ਵਿਵਸਥਾ ਬਹੁਤ ਹੀ ਵਧੀਆ ਹੈ ਲੋਕ ਉੱਥੋਂ ਦੇ ਵਸਨੀਕ ਵੀ ਕਾਨੂੰਨ ਦੀ ਪੂਰੀ ਪਾਲਣਾ ਕਰਦੇ ਹਨ ਮੈਨੂੰ ਦਸ ਸਾਲਾਂ ਦੌਰਾਨ ਕਦੇ ਵੀ ਸੁਰੱਖਿਆ ਸੰਬੰਧੀ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਨਹੀਂ ਪਿਆ ਜੇਕਰ ਉੱਥੇ ਇਹ ਜਿਹੀ ਕੋਈ ਗੱਲਬਾਤ ਆਮ ਤੌਰ 'ਤੇ ਹੋ ਵੀ ਜਾਂਦੀ ਹੈ ਤਾਂ ਪ੍ਰਸ਼ਾਸਨੀ ਅਧਿਕਾਰੀ ਜਾਂ ਸਰਕਾਰੀ ਅਧਿਕਾਰੀ ਸਾਡਾ ਪੂਰਾ ਸਹਿਯੋਗ ਕਰਦੇ ਹਨ ਅਤੇ ਆਈ ਮੁਸ਼ਕਿਲ ਨੂੰ ਸਾਡੇ ਨਾਲ਼ ਮਿਲਕੇ ਠੀਕ ਕਰਦੇ ਹਨ ਇਸ ਲਈ ਰਾਜਸਥਾਨ ਮੈਨੂੰ ਵਪਾਰ ਲਈ ਬਹੁਤ ਹੀ ਵਧੀਆ ਲੱਗਦਾ ਹੈ ਉੱਥੋਂ ਅਸੀਂ ਜਿੱਥੇ ਵੀ ਰੁਕਦੇ ਹਾਂ ਹੋਟਲ 'ਚ ਸਾਡੇੇ ਸਾਡੇ ਕੋਲ ਬਹੁਤ ਵਾਰੀ ਵੱਧ ਧਨ ਵੀ ਹੁੰਦਾ ਹੈ ਅਤੇ ਸਾਡੇ ਸਮਾਨ ਪ੍ਰਤੀ ਸਾਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਇਸ ਲਈ ਅਸੀਂ ਕਦੇ ਵੀ ਆਪਣੀ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਦਾ ਅਨੁਭਵ ਨਹੀਂ ਕੀਤਾ